ਸਤਿ ਸ੍ਰੀ ਅਕਾਲ ਜੀ ਮੇਰਾ ਫੋਨ ਨੰਬਰ ਨੌਂ ਸੱਤ ਅੱਠ ਸਿਫਰ ਤਿੰਨ ਸਿਫਰ ਪੰਜ ਤਿੰਨ ਸੱਤ ਨੌਂ ਜੋ ਕਿ ਸਵੀਗੀ ਐਪ 'ਤੇ ਰਜਿਸਟਰ ਹੈ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਦੁਪਹਿਰ ਦਾ ਖਾਣਾ ਮੰਗਵਾਉਣਾ ਹੈ ਸਵੀਗੀ ਐਪ ਤੋਂ ਤਾਂ ਮੈਂ ਉਹਦੇ ਵਿੱਚ ਪੁੱਛਣਾ ਚਾਹੁੰਦਾ ਕਿ ਮੈਨੂੰ ਕੋਈ ਛੋਟ ਕੂਪਨ ਮਿਲ ਰਿਹਾ ਜਾਂ ਨਹੀਂ ਅਗਰ ਮਿਲ ਰਿਹਾ ਤਾਂ ਤੁਸੀਂ ਕਿਰਪਾ ਕਰਕੇ ਵੈੱਬਸਾਈਟ ਖੋਲ ਕੇ ਮੈਨੂੰ ਦੱਸੋ ਅਗਰ ਨਹੀਂ ਮਿਲ ਰਿਹਾ ਅਗਰ ਮੈਨੂੰ ਕੋਈ ਵੀ ਛੋਟ ਕੂਪਨ ਨਹੀਂ ਮਿਲ ਰਿਹਾ ਤਾਂ ਮੈਨੂੰ ਦੱਸੋ ਤਾਂ ਜੋ ਮੈਂ ਜਲਦ ਤੋਂ ਜਲਦ ਛੋਟ ਕੂਪਨ ਦਾ ਲਾਭ ਪ੍ਰਾਪਤ ਕਰ ਸਕਾਂ ਅਤੇ ਆਪਣਾ ਦੁਪਹਿਰ ਦਾ ਖਾਣਾ ਮੈਂ ਇਸ ਐਪ ਤੋਂ ਮੰਗਵਾ ਸਕਾਂ ਧੰਨਵਾਦ ਜੀ